ਸਾਡੇ ਭਾਰਤ ਵਿੱਚ ਪੜ੍ਹਾਈ ਬਹੁਤ ਵਧੀਆ ਹੈ ਅਤੇ ਮਤਲਬ ਬਹੁਤ ਵਧੀਆ ਟੀਚਰ ਵੀ ਐਂ ਅਤੇ ਪੜ੍ਹਾਉਂਦੇ ਵੀ ਵਧੀਆ ਹੈ ਬਟ ਇੱਥੇ ਮਤਲਬ ਫ਼ੀਸ ਮਤਲਬ ਅਲੱਗ ਅਲੱਗ ਕੋਰਸਾਂ ਦੀ ਫ਼ੀਸ ਬਹੁਤ ਮਹਿੰਗੀ ਹੈ ਅਤੇ ਜਿਸ ਕਰਕੇ ਬੱਚੇ ਪੜ੍ਹ ਨਹੀਂ ਸਕਦੇ ਐਂ ਅਤੇ ਕੁੜੀਆਂ ਦੀ ਫ਼ੀਸ ਥੋੜ੍ਹੀ ਘੱਟ ਹੋਣੀ ਚਾਹੀਦੀ ਹੈ ਜਿਹਦੇ ਕਰਕੇ ਜੇ ਘੱਟ ਹੋਣੀ ਹੈ ਤਾਂ ਬ ਮਤਲਬ ਬੱਚੇ ਪ ਪੜ੍ਹ ਵੀ ਸਕਦੇ ਐਂ ਅਤੇ ਜੇ ਜੇ ਫ਼ੀਸ ਹੀ ਇੰਨੀ ਹੁੰਦੀ ਹੈ ਤਾਂ ਬੱਚੇ ਪੜ੍ਹ ਵੀ ਸਕ ਬੱਚੇ ਪੜ੍ਹ ਵੀ ਨਹੀਂ ਪਾਂਦੇ ਹੈ ਅਤੇ ਮਤਲਬ ਓ ਜਿਹੜੀ ਆਪਣੀ ਮੰਜ਼ਿਲ ਹੈ ਉਹ ਹਾਸਿਲ ਵੀ ਨਹੀਂ ਕਰ ਸਕਦੇ ਹਨ ਅਤੇ ਸਾਨੂੰ ਮਤਲਬ ਬੱਚਿਆਂ ਨੂੰ ਸਕੂਲਾਂ ਵਿੱਚ ਅ ਅਲੱਗ ਅਲੱਗ ਚੀਜ਼ਾਂ ਬਾਰੇ ਦੱਸਣਾ ਵੀ ਚਾਹੀਦਾ ਹੈ ਅਤੇ ਇੱਥੇ ਥਿਊਰੀ ਜ਼ਿਆਦਾ ਕਰਾਉਂਦੇ ਅਤੇ ਬਾਹਰਲੇ ਦੇਸ਼ਾਂ ਵਿੱਚ ਪ੍ਰੈਕਟੀਕਲ ਜ਼ਿਆਦਾ ਕਰਾਉਂਦੇ ਅਤੇ ਇਸ ਕਰਕੇ ਸਾਡੇ ਬੱਚੇ ਪਿਛ ਪਿੱਛੇ ਰਹਿ ਜਾਂਦੇ ਹੈ ਅਤੇ ਸਾਨੂੰ ਮਤਲਬ ਬੱਚਿਆਂ ਨੂੰ ਪੁਰਸਕਾਰ ਵਗੈਰਾ ਵੀ ਦੇਣਾ ਚਾਹੀਦਾ ਹੈ ਕਿ ਮਤਲਬ ਮਤਲਬ ਉਤਸ਼ਾਹਿਤ ਹੋਣ ਮਤਲਬ ਨੌਲੇਜ ਬਡੇ ਮਤਲਬ ਗੇਮਸ ਵਿੱਚ ਪਾਰਟੀਸਪੇਟਸ ਲੈਣ ਅਤੇ ਇਸ ਕਰਕੇ ਕਰਨਾ ਚਾਹੀਦਾ ਹੈ